ਹਫ਼ਤੇ ਪਹਿਲਾਂ ਮੈਂ ਰੈੱਡਟੇਪ ਦੇ ਬੂਟ ਲਿਤੇ ਸਨ ਉਹ ਸੀ ਭੱਜਣੇ ਵਾਲ਼ੇ ਬੂਟ ਅਤੇ ਉਹਨਾਂ ਦਾ ਰ ਜਿਹੜਾ ਰਿਸਪੌਂਸ ਸੀ ਉਹ ਬਹੁਤ ਵਧੀਆ ਸੀਗਾ ਮੈਂ ਉਹਨੂੰ ਦ ਹਫ਼ਤਾ ਹੋ ਗਿਆ ਜੀ ਉਹਨਾਂ ਨੂੰ ਯੂਜ਼ ਕਰ ਰਿਹਾ ਉਹਨਾਂ ਵਿੱਚ ਐਨ ਪੈਰ ਅਰਾਮਦਾਇਕ ਰਹਿੰਦੇ ਹਨ ਬੰਦਾ ਥੱਕਦੇ ਨਹੀਂ ਪੈਰ ਉਹ ਬਹੁਤ ਹੀ ਵਧੀਆ ਬੂਟ ਪ੍ਰੋਵਾਈਡ ਕਰਦੇ ਹਨ